ਮੈਂ ਬਹੁਤ ਸਾਰੀਆਂ ਰਿਐਲਟੀ ਗੇਮਾਂ ਖੇਡੀਆਂ ਹਨ ਉਹਨਾਂ ਵਿੱਚ ਇੱਕ ਪਬਜੀ ਵੀ ਹੈ ਪਬਜੀ ਦੇ ਵਿੱਚ ਚਾਰ ਮੈਂਬਰਾਂ ਦਾ ਇੱਕ ਟੀਮ ਬਣਦੀ ਹੈ ਅਤੇ ਪੂਰੇ ਗਰੁੱਪ ਦੇ ਵਿੱਚ ਸੌ ਮੈਂਬਰ ਹੁੰਦੇ ਹਨ ਅਤੇ ਜਿਹਨਾਂ ਨੂੰ ਮਾਰ ਕੇ ਪਹਿਲੇ ਨੰਬਰ 'ਤੇ ਆਉਣਾ ਹੁੰਦਾ ਹੈ ਜਿਹੜਾ ਵੀ ਵਿਅਕਤੀ ਸਾਰੇ ਬੰਦਿਆਂ ਨੂੰ ਮਾਰ ਕੇ ਪਹਿਲੇ ਨੰਬਰ 'ਤੇ ਆਉਂਦਾ ਹੈ ਉਸ ਨੂੰ ਜੇਤੂ ਮੰਨਿਆ ਹੈ